ਜੀ ਹਾਂ ਮੈਨੂੰ ਕਈ ਤਰ੍ਹਾਂ ਦੇ ਪਕਵਾਨ ਬਣਾਉਣਾ ਬਹੁਤ ਪਸੰਦ ਹਨ ਅਕਸਰ ਅਸੀਂ ਘਰ ਵਿੱਚ ਬਹੁਤ ਹੀ ਤਰ੍ਹਾਂ ਦੇ ਪਕਵਾਨ ਬਣਾਉਂਦੇ ਰਹਿੰਦੇ ਹਾਂ ਜਿਵੇਂ ਮਿੱਠੇ ਚੌਲ ਸ਼ਿਰਦ ਵਾਲੇ ਚੌਲ ਪਕੌੜੇ ਆਦਿ ਅਸੀਂ ਬਣਾਉਂਦੇ ਰਹਿੰਦੇ ਹਾਂ ਮੈਨੂੰ ਖਾਣਾ ਬਣਾਉਣਾ ਬਹੁਤ ਚੰਗਾ ਲਗਦਾ ਹੈ ਮੈਂ ਜ਼ਿਆਦਾਤਰ ਖਾਣਾ ਬਣਾਉਂਦੀ ਰਹਿੰਦੀ ਹਾਂ ਅਤੇ ਮੈਨੂੰ ਨਵੀਆਂ ਨਵੀਆਂ ਡਿਸ਼ਿਜ਼ ਬਣਾਉਣਾ ਵੀ ਬਹੁਤ ਪਸੰਦ ਹੈ ਖਾਣੇ ਨੂੰ ਲੈ ਕੇ ਮੈਂ ਹੋਟਲ ਮਨੈਜਮੈਂਟ ਵੀ ਆਪਣੇ ਦਿਮਾਗ ਵਿੱਚ ਲਿਆਂਦਾ ਕਿ ਮੈਂ ਇਹ ਹੀ ਕੋਰਸ ਕਰੂੰਗੀ ਕਿਉਂਕਿ ਮੈਨੂੰ ਕੁਕਿੰਗ ਵਿੱਚ ਬਹੁਤ ਹੀ ਇੰਟਰਸਟ ਹੈ ਅਤੇ ਖਾਣਾ ਬਣਾਉਣਾ ਮੈਨੂੰ ਬਹੁਤ ਚੰਗਾ ਲਗਦਾ ਹੈ ਕਈ ਲੋਕ ਤਾਂ ਖਾਣਾ ਬਣਾਉਣ ਤੋਂ ਬਹੁਤ ਨਾ ਵਜੋਂ ਵਰਤਦੇ ਹਨ ਵੀ ਅਸੀਂ ਇਹ ਕੰਮ ਨਹੀਂ ਕਰ ਸਕਦੇ ਪਰ ਮੈਨੂੰ ਖਾਣਾ ਬਣਾਉਣਾ ਬਹੁਤ ਚੰਗਾ ਲਗਦਾ ਹੈ ਅਤੇ ਮੈਂ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੀ ਰਹਿੰਦੀ ਹਾਂ ਅਤੇ ਆਪਣੇ ਘਰਦਿਆਂ ਨੂੰ ਖੁਸ਼ ਕਰਦੀ ਹਾਂ ਧੰਨਵਾਦ